ਮੈਂ ਐਪਲ ਕੰਪਨੀ ਦਾ ਫ਼ੋਨ ਪਹਿਲੀ ਵਾਰ ਖਰੀਦਿਆ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਇਸਨੂੰ ਚਲਾਉਣ ਦਾ ਢੰਗ ਅਤੇ ਕੈਮਰਾ ਮੈਨੂੰ ਬਾਕੀ ਕੰਪਨੀ ਦੇ ਫ਼ੋਨਾਂ ਤੋਂ ਬਹੁਤ ਵੱਖਰਾ ਅਤੇ ਵਧੀਆ ਲੱਗਿਆ